ਸਕੂਲਾਂ ਵਿੱਚ ਵੈਸੇ ਤਾਂ ਸ਼ਿਲਪਕਾਰੀ ਜਾਂ ਕਲਾ ਦਾ ਕੰਮ ਬਹੁਤ ਘੱਟ ਸਿਖਾਇਆ ਜਾਂਦਾ ਹੈ ਜੇ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਕ ਕੰਮ ਕੋਲਜਾਂ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਜਿੱਦਾਂ ਕੀ ਯੂਥ ਫੈਸਟੀਵਲ ਹੁੰਦੇ ਨੇ ਉੱਥੇ ਬੱਚਿਆਂ ਨੂੰ ਦਿਖਾਇਆ ਜਾਂਦਾ ਮਿੱਟੀ ਦੇ ਕਿਵੇਂ ਭਾਂਡੇ ਬਣਾਉਣੇ ਆ ਬੁੱਤ ਬਣਾਉਣੇ ਆ ਜਾਂ ਪੀੜੀਆਂ ਬੁਣਨਾ ਅਤੇ ਟੋਕਰੀਆਂ ਬਣਾਉਣੀਆਂ ਹੋਰ ਵੀ ਜਿੰਨੇ ਹੱਥ ਦੇ ਕੰਮ ਹੁੰਦੇ ਨੇ ਬਹੁਤ ਜ਼ਿਆਦਾ ਸਿਖਾਏ ਜਾਂਦੇ ਆ ਅਤੇ ਜੋ ਕਿ ਉਹਨਾਂ ਨੇ ਅੱਗੇ ਜਾ ਕੇ ਕੰਮ ਆਉਣ ਬਚਪਨ ਵਿੱਚ ਅਸੀਂ ਮੀਂਹ ਦੇ ਸਮੇਂ ਬਹੁਤ ਸਾਰੀਆਂ ਕਿਸ਼ਤੀਆਂ ਬਣਾ ਕੇ ਚਲਾਈਆਂ ਹਨ ਜਿਵੇਂ ਕਿ ਗੁੱਡੀਆਂ ਬਣਾਉਂਦੇ ਹੁੰਦੇ ਸੀਗੇ ਜਦ ਕਦੇ ਮੀਂਹ ਨਹੀਂ ਪੈਂਦਾ ਸੀਗਾ ਗੁੱਡੀ ਬਣਾ ਕੇ ਫੂਕ ਦਿੰਦੇ ਸੀਗੇ ਤਾਂ ਕਿ ਮੀਂਹ ਪੈ ਸਕੇ ਚੌਲਾਂ ਦਾ ਜੱਗ ਲਾਉਂਦੇ ਸੀਗੇ ਇੱਦਾਂ ਹੀ ਮਤਲਬ ਕਿ ਕਾਗਜ਼ ਦੀ ਬੰਦੂਕ ਬਣਾ ਲੈਣੀ ਹੋਰ ਕਾਗਜ਼ ਦਾ ਡੱਡੂ ਬਣਾ ਦੇਣਾ ਇੱਦਾਂ ਦੀਆਂ ਬਹੁਤ ਯਾਦਾਂ ਨੇ ਬਚਪਨ ਦੀਆਂ ਜੋ ਮੇਰੇ ਯਾਦ ਨੇ